ਦੋ ਸੌ ਕਿਲੋਮੀਟਰ ਤੇ ਇਸ ਸਫਰ ਦੌਰਾਨ ਸਾਨੂੰ ਕਈ ਅਹਿਮ ਤਜਰਬੇ ਵੀ ਹੋਏ ਅਸੀਂ ਜਿੱਥੇ ਸਾਡਾ ਦਿਲ ਕਰਦਾ ਸੀ ਉੱਥੇ ਗੱਡੀ ਰੋਕ ਵੀ ਲੈਂਦੇ ਸਾਂ ਅਤੇ ਜਿੱਥੇ ਕਿਤੇ ਚਾਹ ਪਾਣੀ ਪੀਣਾ ਹੁੰਦਾ ਸੀ ਉੱਥੇ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਆਪਣੀ ਮੰਜ਼ਿਲ ਵੱਲ ਚੱਲ ਪੈਂਦੇ ਸਾਂ ਉੱਥੇ ਜਾ ਕੇ ਅਸੀਂ ਗੱਡੀ ਪਾਰਕ ਕਰਕੇ ਆਪਣਾ ਸ਼ਰਧਾ ਨਾਲ ਜਿੱਥੇ ਮੱਥਾ ਟੇਕਣਾ ਸੀ ਮੱਥਾ ਟੇਕਿਆ ਜਿਸ ਕਿਸੇ ਨੂੰ ਵੀ ਮਿਲਣਾ ਸੀ ਅਸੀਂ ਮਿਲੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਚੱਲਦਾ ਰਿਹਾ ਰਾਤ ਦਾ ਸਫਰ ਅਸੀਂ ਨਹੀਂ ਕਰਦੇ ਸਾਂ ਰਾਤ ਨੂੰ ਅਸੀਂ ਹੋਟਲ ਦੇ ਕਮਰੇ ਦੇ ਅੱਗੇ ਗੱਡੀ ਖੜ੍ਹਾ ਕੇ ਆਰਾਮ ਨਾਲ ਸੌਂ ਜਾਂਦੇ ਸਾਂ ਅਤੇ ਸਵੇਰੇ ਉੱਠ ਕੇ ਉੱਥੋਂ ਚੱਲ ਪੈਂਦੇ ਸਾਂ ਇਸ ਕਰਕੇ ਸਾਨੂੰ ਰੈਂਟ 'ਤੇ ਗੱਡੀ ਲਿਜਾ ਕੇ ਬੜਾ ਵਧੀਆ ਲੱਗਿਆ ਇਸ ਨਾਲੋਂ ਵਧੀਆ ਸੀ ਵੀ ਅਸੀਂ ਆਪ ਹੀ ਚਲੇ ਜਾਂਦੇ